ਮੇਰੇ ਪਿਆਰੇ ਦੋਸਤ ਮੇਰੀ ਇੱਕ ਉਲਝਣ ਹੈ ਜੋ ਕਿ ਰੇਲ ਬੁਕਿੰਗ ਦੇ ਨਾਲ ਹੈ ਜਿਸ ਵਿੱਚ ਮੈਂ ਤੇਰੇ ਤੋਂ ਇਸ ਬੁਕਿੰਗ ਦੇ ਵਿੱਚ ਜਿਹੜਾ ਕੋਟਾ ਸਿਸਟਮ ਹੈਗਾ ਹੈ ਉਸ ਬਾਰੇ ਪੁੱਛਦਾ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਹਦੇ ਵਿੱਚ ਵੱਖ ਵੱਖ ਸ਼੍ਰੇਣੀਆਂ ਹੁੰਦੀਆਂ ਹਨ ਉਹਦੇ ਵਿੱਚ ਆਪਣੀ ਵੇਟਿੰਗ ਕਿਵੇਂ ਪੂਰੀ ਹੋ ਸਕਦੀ ਹੈ ਇਸ ਬਾਰੇ ਮੈਨੂੰ ਪੂਰੀ ਜਾਣਕਾਰੀ ਦੇ ਦਿਓ